ਅੱਜ ਕੱਲ੍ਹ ਦੇ ਟਾਈਮ 'ਤੇ ਜੋ ਵੀ ਤਕਨੀਕੀ ਸੁਵਿਧਾ ਸਾਨੂੰ ਮਿਲ ਰਹੀ ਹੈ ਉਸ ਦੇ ਵਿੱਚ ਦੇਖੀਏ ਤਾਂ ਜਿਵੇਂ ਸਮਾਰਟਫੂਨ ਹੋ ਗਿਆ ਟੀ ਵੀ ਹੋ ਗਈ ਸੋਸ਼ਲ ਮੀਡੀਆ ਹੋ ਗਿਆ ਇੰਟਰਨੈਟ ਹੋ ਗਿਆ ਉਹ ਸਾਰਿਆਂ ਦੇ ਜ਼ਰੀਏ ਅਸੀਂ ਆਪਸ ਵਿੱਚ ਜੋ ਵੀ ਦੁਨੀਆਂ ਦੇ ਵਿੱਚ ਚੱਲ ਰਿਹਾ ਹੈ ਉਹਦੇ ਨਾਲ ਜੁੜੇ ਰਹਿਣਾ ਚਾਹੁਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਆਸ ਪਾਸ ਹੋ ਰਿਹਾ ਹੈ ਕੋਈ ਖੁਸ਼ੀ ਦੀ ਖਬਰ ਹੈ ਜਾਂ ਕਿਸ ਤਰ੍ਹਾਂ ਦਾ ਕੋਈ ਦੁੱਖ ਦੁੱਖ ਦੀ ਖ਼ਬਰ ਹੈ ਉਹ ਸਾਨੂੰ ਪਤਾ ਚੱਲਦੀ ਰਹੇ ਉਹਦੇ ਲਈ ਅਸੀਂ ਕਾਫ਼ੀ ਇੰਟਰਨੈਟ ਦੇ ਉੱਪਰ ਕਾਫ਼ੀ ਸੇਵਾਵਾਂ ਤੁਹਾਨੂੰ ਮਿਲ ਜਾਣਗੀਆਂ ਜਿਸ ਦੇ ਵਿੱਚ ਯੂਟੀਊਬ ਹੋ ਗਈ ਜਾਂ ਸੋਸ਼ਲ ਮੀਡੀਆ ਹੋ ਗਿਆ ਉਸ 'ਤੇ ਅੱਜ ਕੱਲ੍ਹ ਸਭ ਕੁਛ ਤੁਹਾਨੂੰ ਮਿਲ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਖ਼ਬਰ ਦੀ ਲੋੜ ਹੈ ਤੁਸੀਂ ਖ਼ਬਰ ਸੁਣਨਾ ਚਾਹੁੰਦੇ ਓਂ ਕਿਸੇ ਤਰ੍ਹਾਂ ਦਾ ਵੀ ਕੋਈ ਖੇਲ ਚੱਲ ਰਿਹਾ ਹੈ ਦੁਨੀਆਂ ਦੇ ਵਿੱਚ ਉਹ ਤੁਸੀਂ ਦੇਖਣਾ ਚਾਹੁੰਦੇ ਓਂ ਸੰਗੀਤ ਸੁਣਨਾ ਚਾਹੁੰਦੇ ਓਂ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਮੂਵੀ ਦੇਖਣਾ ਚਾਹੁੰਦੇ ਓਂ ਉਹ ਸਭ ਕੁਛ ਤੁਸੀਂ ਜੋ ਹੈ ਇਸ ਤਕਨੀਕਾਂ ਦੇ ਦੁਆਰਾ ਤੁਸੀਂ ਦੇਖ ਸਕਦੇ ਹੋ ਉਹਨਾਂ ਨਾਲ ਜੁੜ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਚਾਹੁੰਦੇ ਓਂ ਕਿਸੇ ਵੀ ਕਿਸੇ ਦੇ ਨਾਲ ਤੁਹਾਡੇ ਵਿਚਾਰ ਮਿਲਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਓਂ ਉਸ ਵਿਚਾਰਾਂ ਉੱਪਰ ਤੁਸੀਂ ਦੇਖ ਸਕਦੇ ਓਂ ਕਿ ਸਾਹਮਣੇ ਵਾਲਾ ਇਨਸਾਨ ਕੀ ਸੋਚ ਰਿਹਾ ਇਸ ਦੁਨੀਆ ਬਾਰੇ ਕੀ ਸੋਚਦਾ ਹੈ ਉਸਦੇ ਮਨ ਦੇ ਅੰਦਰ ਕੀ ਚੱਲ ਰਿਹਾ ਦਿਮਾਗ ਦੇ ਅੰਦਰ ਕੀ ਚੱਲ ਰਿਹਾ ਯੂਟਿਊਬ ਦੇ ਉੱਪਰ ਤੁਹਾਨੂੰ ਬਹੁਤ ਕੁਝ ਮਿਲ ਜਾਵੇਗਾ ਜੋ ਵੀ ਤਕਨੀਕ ਅੱਜ ਕੱਲ੍ਹ ਦੀਆਂ ਜੋ ਵੀ ਨਵੀਆਂ ਤਕਨੀਕਾਂ ਆਈਆਂ ਹਨ ਜਿਨਾਂ ਨੇ ਸਾਡੀ ਜ਼ਿੰਦਗੀ ਆਸਾਨ ਕੀਤੀ ਹੈ ਉਹ ਸਭ ਕੁਛ ਤੁਹਾਨੂੰ ਇੰਟਰਨੈਟ ਉੱਪਰ ਮਿਲ ਜਾਵੇਗਾ